ਕਿਸਾਨ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਪੈਦਾ ਕਰਦਾ ਹੈ ਪਰ ਮੁੱਖ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਧਾਨ ਦੀ ਫਸਲ ਕਣਕ ਦੀ ਫਸਲ ਕਿਸਾਨ ਜ਼ਿਆਦਾਤਰ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਦੀ ਐੱਮ ਐੱਸ ਪੀ ਸਰਕਾਰ ਵੱਲੋਂ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਕਿਸਾਨ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਜਿਵੇਂ ਕਿ ਟੋਮੈਟੋ ਬਰੋਕਲੀ ਕੌਲੀ ਫਲਾਵਰ ਪਟੈਟੋ ਆਦਿ ਵੀ ਪੈਦਾ ਕਰਦਾ ਹੈ ਇਸ ਤੋਂ ਇਲਾਵਾ ਤੇਲ ਵਾਲੀਆਂ ਫਸਲਾਂ ਸਰਸੋਂ ਆਦਿ ਦੀ ਖੇਤੀ ਵੀ ਕਿਸਾਨ ਦੁਆਰਾ ਕੀਤੀ ਜਾਂਦੀ ਹੈ